ਰੇਲ ਗੱਡੀਆਂ ਭਾਰਤ ਵਿੱਚ ਕਈ ਤਰ੍ਹਾਂ ਦੀਆਂ ਹਨ ਆਧੁਨਿਕ ਯੁੱਗ ਵਿੱਚ ਭਾਰਤ ਨੇ ਰੇਲ ਸਫ਼ਰ ਵਿੱਚ ਬਹੁਤ ਤਰੱਕੀ ਕਰੀ ਹੈ ਅੱਜ ਕੱਲ੍ਹ ਭਾਰਤ ਵਿੱਚ ਬੁਲਟ ਟ੍ਰੇਨ ਚੱਲਣ ਦੇ ਆਸਾਰ ਹਨ ਭਾਰਤ ਸ਼ਤਾਬਦੀ ਵਰਗੀਆਂ ਰੇਲਾਂ ਦਾ ਸਫ਼ਰ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ ਜਿਸ ਦੀਆਂ ਸੀਟਾਂ ਬਹੁਤ ਹੀ ਅਰਾਮਦਾਇਕ ਅਤੇ ਬਿਜਲੀ 'ਤੇ ਚੱਲਣ ਵਾਲਾ ਇੰਜਨ ਦਾ ਸ਼ੋਰ ਬਹੁਤ ਹੀ ਘੱਟ ਹੈ ਜਿਸ ਦੇ ਅੰਦਰ ਬੈਠ ਕੇ ਹਵਾਈ ਜਹਾਜ਼ ਵਰਗੀ ਸਹੂਲਤ ਮਿਲਦੀ ਹੈ ਭਾਰਤ ਵਿੱਚ ਜੋ ਨਵੇਂ ਰੇਲਵੇ ਟਰੈਕ ਬਣੇ ਹਨ ਉਹ ਪਹਿਲਾਂ ਦੇ ਮੁਕਾਬਲੇ ਕਾਫ਼ੀ ਵਧੀਆ ਹਨ ਅਤੇ ਅੱਜ ਦੀ ਰੇਲ ਦੇ ਇੰਜਨ ਪੁਰਾਣੇ ਰੇਲ ਇੰਜਨਾਂ ਨਾਲੋਂ ਆਧੁਨਿਕ ਹਨ ਜਿਸ ਨਾਲ ਰੇਲ ਰਫ਼ਤਾਰ ਬਹੁਤ ਵੱਧ ਹੈ ਅਤੇ ਯਾਤਰੀਆਂ ਨੂੰ ਘੱਟ ਸਮੇਂ ਵਿੱਚ ਆਪਣੀ ਮੰਜ਼ਿਲ 'ਤੇ ਪਹੁੰਚਾ ਦਿੰਦੀਆਂ ਹਨ ਪਿਛਲੇ ਸਮੇਂ ਵਿੱਚ ਕੋਲੇ 'ਤੇ ਚੱਲਣ ਵਾਲੀਆਂ ਰੇਲਾਂ ਅਤੇ ਡੀਜ਼ਲ 'ਤੇ ਚੱਲਣ ਵਾਲੀਆਂ ਰੇਲਾਂ ਦੇ ਇੰਜਨ ਬਹੁਤ ਸ਼ੋਰ ਕਰਦੇ ਸਨ ਅਤੇ ਉਸ ਦੇ ਡੱਬਿਆਂ ਅੰਦਰ ਬੈਠਣ ਲਈ ਸੀਟਾਂ ਵੀ ਘੱਟ ਆਰਾਮਦਾਇਕ ਹੁੰਦੀਆਂ ਸਨ ਜਿਸ ਨਾਲ ਯਾਤਰੀਆਂ ਨੂੰ ਲੰਬਾ ਸਫ਼ਰ ਕਰਨ ਵਿੱਚ ਪਰੇਸ਼ਾਨੀ ਹੁੰਦੀ ਸੀ ਪਰ ਅੱਜ ਕੱਲ੍ਹ ਇਹ ਸਾਰੀਆਂ ਪਰੇਸ਼ਾਨੀਆਂ ਰੇਲਵੇ ਨੇ ਦੂਰ ਕਰ ਦਿੱਤੀਆਂ ਹਨ ਹੁਣ ਯਾਤਰੀਆਂ ਨੂੰ ਰੇਲਵੇ ਵਿੱਚ ਵਧੀਆ ਸਫਾਈ ਅਤੇ ਆਰਾਮਦਾਇਕ ਸੀਟਾਂ ਮਿਲਦੀਆਂ ਹਨ ਅਤੇ ਲੰਬਾ ਸਫ਼ਰ ਵੀ ਸੌਖਾ ਹੋ ਜਾਂਦਾ ਹੈ ਪਿਛਲੇ ਦਿਨੀਂ ਮੈਂ ਆਪਣੇ ਸ਼ਹਿਰ ਤੋਂ ਸ਼੍ਰੀ ਅਯੋਧਿਆ ਧਾਮ ਦੀ ਰੇਲ ਯਾਤਰਾ ਕੀਤੀ ਜਿਸ ਦਾ ਅਨੁਭਵ ਬਾਕੀ ਯਾਤਰਾਵਾਂ ਨਾਲੋਂ ਵਧੀਆ ਸੀ ਸਫ਼ਰ ਵਿੱਚ ਸਾਨੂੰ ਰਾਮ ਭਗਤਾਂ ਨੇ ਵੱਖ ਵੱਖ ਸਟੇਸ਼ਨਾਂ 'ਤੇ ਰੋਕ ਕੇ ਸਾਡਾ ਜੀ ਆਇਆਂ ਕੀਤਾ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਸੇਵਾਦਾਰਾਂ ਵੱਲੋਂ ਟ੍ਰੇਨ ਵਿੱਚ ਕੀਤਾ ਗਿਆ ਇਹ ਸਫ਼ਰ ਬਾਕੀ ਰੇਲ ਸਫ਼ਰ ਨਾਲੋਂ ਵਿਲੱਖਣ ਸੀ ਇਹ ਮੇਰੀ ਜ਼ਿੰਦਗੀ 'ਚ ਯਾਦਗਾਰ ਸਫ਼ਰ ਬਣ ਕੇ ਰਹਿ ਗਿਆ